ਹੈਲੋ

ਸਤਿ ਸ਼੍ਰੀ ਅਕਾਲ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਅਤੇ ਕੋਈ ਗੱਲ ਨਹੀਂ ਤੁਸੀਂ ਆਓ ਪਿੰਡ 'ਚ ਇੱਧਰ ਗੁਰਦਾਸਪੁਰ 'ਚ ਪਿੰਡ ਪੈਂਦਾ ਸਾਡਾ ਤੁਸੀਂ ਆਓ ਘੁੰਮ ਫਿਰ ਕੇ ਜਾਓ ਨਾਲੇ ਵੇਖ ਕੇ ਜਾਓ ਕਲਚਰ ਪਿੰਡਾਂ ਦਾ ਅਤੇ ਰਹਿਣ ਸਹਿਣ ਪਿੰਡਾਂ ਵਾਲਿਆਂ ਦਾ ਸਿੰਪਲ ਹੁੰਦਾ ਆ ਬਿਲਕੁਲ ਖਾਣਾ ਪੀਣਾ ਵੀ ਸਾਦਾ ਹੀ ਖਾਂਦੇ ਨੇ ਅਤੇ ਰੋਟੀ ਪਾਣੀ ਵੀ ਚੁੱਲ੍ਹੇ 'ਤੇ ਬਣਾਉਂਦੇ ਨੇ ਗੈਸ ਜ਼ਿਆਦਾ ਯੂਜ ਨਹੀਂ ਕਰਦੇ ਅਤੇ ਸਬਜ਼ੀਆਂ ਵੀ ਲਾਈਆਂ ਹੋਈਆਂ ਨੇ ਘਰੇ ਖੇਤਾਂ 'ਚ ਦੇਸੀ ਖਾਦ ਪਾ ਕੇ ਰੂੜ੍ਹੀ ਪਾ ਕੇ ਸਬਜ਼ੀਆਂ ਜਿਹੜੀਆਂ ਉਹ ਹੁੰਦੀਆਂ ਨੇ ਪਿਓਰ ਹੁੰਦੀਆਂ ਨੇ ਮਤਲਬ ਕੋਈ ਉਹਨਾਂ 'ਚ ਬਿਮਾਰੀਆਂ ਨਹੀਂ ਲੱਗਦੀਆਂ ਘਰ ਦੀਆਂ ਹੀ ਸਬਜ਼ੀਆਂ ਹੁੰਦੀਆਂ ਨੇ ਘਰ ਦੇ ਹੀ ਚਾਵਲ ਆਟਾ ਸਾਰਾ ਕੁਛ ਹੁੰਦਾ ਆ ਸਿੰਪਲ ਰਹਿਣਾ ਹੈ ਲੋਕਾਂ ਦਾ ਕੋਈ ਪਹਿਰਾਵਾ ਨਹੀਂ ਫਾਲਤੂ ਅਤੇ ਮੇਲ ਮਿਲਾਪ ਵਧੀਆ ਆ ਰਲ ਮਿਲ ਕੇ ਰਹਿੰਦੇ ਨੇ ਲੋਕ ਖੇਤੀਬਾੜੀ ਬੱਸ ਆਹੀ ਹੁਣ ਤਾਂ ਚਲੋ ਹੋਰ ਔਜ਼ਾਰ ਚੱਲ ਗਏ ਨੇ ਬਥੇਰੇ ਪਰ ਪਹਿਲਾਂ ਤਾਂ ਲੋਕ ਵਗੈਰਾ ਨਾਲ ਹੀ ਕਰਦੇ ਸੀਗੇ ਅੱਜ ਕੱਲ੍ਹ ਤਾਂ ਬਥੇਰਾ ਕੁਝ ਚੱਲਿਆ ਹੈ ਖੇਤੀ ਦੇ ਵਿੱਚ ਕਣਕ ਬੀਜਦੇ ਨੇ ਅਤੇ ਝੋਨਾ ਬੀਜਦੇ ਨੇ ਦੋ ਫਸਲਾਂ ਹੁੰਦੀਆਂ ਜ਼ਿਆਦਾਤਰ ਸਾਡੇ ਪੰਜਾਬ 'ਚ ਪਿੰਡਾਂ 'ਚ ਹਾਂਜੀ ਹਾਂਜੀ ਅਤੇ ਕੋਈ ਗੱਲ ਨਹੀਂ ਤੁਸੀਂ ਆਇਓ ਘੁੰਮਣ ਆਇਓ ਤਾਂ ਘੁੰਮ ਕੇ ਜਾਓ ਵੇਖ ਚਾਖ ਕੇ ਜਾਓ ਸਾਰਾ ਕੁਛ ਹਾਂਜੀ ਤੁਸੀਂ ਉਹ ਤਾਂ ਖਾਦਾਂ ਤਾਂ ਵੈਸੇ ਘਾਤਕ ਹੀ ਨੇ ਪਰ ਦੇਸੀ ਖਾਦਾਂ ਜਿਹੜੀਆਂ ਪਾਈਆਂ ਜਾਣ ਉਹ ਸਗੋਂ ਵਧੀਆ ਨੇ ਜਿੱਦਾਂ ਰੁੜ੍ਹੀ ਦੀ ਖਾਦ ਹੋਰ ਜਿੱਦਾਂ ਚੁੱਲ੍ਹਿਆਂ ਦੀ ਸੁਆਹ ਹੋਰ ਕਈ ਕੁਛ ਹੁੰਦਾ ਦੇਸੀ ਹਾਂਜੀ ਉਹ ਵਧੀਆ ਨੇ ਉਹਦੇ ਨਾਲ ਫਸਲਾਂ ਹੋਣ ਤਾਂ ਉਹ ਚੰਗੀਆਂ ਨੇ ਕੋਈ ਮਤਲਬ ਬਿਮਾਰੀ ਵਗੈਰਾ ਨਹੀਂ ਲੱਗਦੀ ਨਾ ਹਾਂਜੀ

ਕੋਈ ਗੱਲ ਨਹੀਂ ਆਇਓ ਖਾਣਾ ਪੀਣਾ ਖਾ ਕੇ ਜਾਇਓ ਘਰ ਦਾ ਦੇਸੀ ਅੱਜ ਕੱਲ੍ਹ ਤਾਂ ਸਾਗ ਵੀ ਬਣਦਾ ਆ ਸਿਆਲਾਂ ਦੇ ਵਿੱਚ ਹੁਣ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਇਓ ਘੁੰਮ ਕੇ ਜਾਇਓ ਸ਼ਹਿਰਾਂ ਅਤੇ ਪਿੰਡਾਂ 'ਚ ਫਰਕ ਇਹ ਹੈ ਕਿ ਪਿੰਡਾਂ 'ਚ ਖੁੱਲ੍ਹਾ ਵਾਤਾਵਰਨ ਹੁੰਦਾ ਆ ਤਾਜ਼ੀ ਹਵਾ ਮਿਲਦੀ ਹੈ ਖਾਣਾ ਪੀਣਾ ਤਾਜ਼ਾ ਆ ਲੋਕਾਂ ਦਾ ਮੇਲ ਮਿਲਾਪ ਜ਼ਿਆਦਾ ਆ ਸ਼ਹਿਰਾਂ ਦੇ ਲੋਕ ਜ਼ਰਾ ਖੁਸ਼ਕ ਨੇ ਅਤੇ ਬਾਹਰੋਂ ਖਾਣਾ ਪੀਣਾ ਵੀ ਬਾਹਰੋਂ ਹੀ ਮੰਗਾਉਂਦੇ ਨੇ ਪਿੰਡਾਂ ਦੇ ਲੋਕ ਫਾਸਟਫੂਡ ਨਹੀਂ ਖਾਂਦੇ ਜ਼ਿਆਦਾ ਸ਼ਹਿਰਾਂ ਦੇ ਲੋਕ ਖਾਂਦੇ ਨੇ ਫਾਸਟਫੂਡ ਇੱਧਰ ਉੱਧਰ ਦੀਆਂ ਚੀਜ਼ਾਂ ਜਿਹਦੇ ਨਾਲ ਬਿਮਾਰੀਆਂ ਵੀ ਬੜੀਆਂ ਹੁੰਦੀਆਂ ਨੇ ਪਿੰਡਾਂ ਦੇ ਲੋਕ ਸਿੰਪਲ ਖਾਣਾ ਖਾਂਦੇ ਆ ਬਸ ਦਾਲ ਰੋਟੀ ਆਪਣਾ ਅਤੇ ਤੰਦਰੁਸਤ ਰਹਿੰਦੇ ਨੇ ਹਾਂਜੀ ਹਾਂਜੀ ਓਕੇ ਓ ਠੀਕ ਹੈ ਠੀਕ ਹੈ